ਇਸ ਤਰ੍ਹਾਂ ਹੈ ਕਿ ਮੈਂ ਪਿਛਲੇ ਦੋ ਸਾਲਾਂ ਤੋਂ ਆਪਣੇ ਬਿਜਲੀ ਬਿੱਲਾਂ ਦਾ ਭੁਗਤਾਨ ਨਹੀਂ ਕਰ ਸਕੀ ਮੇਰਾ ਨਵਾਂ ਪਤਾ ਅੰਮ੍ਰਿਤਸਰ ਗਲੀ ਨੰਬਰ ਦੋ ਮਕਾਨ ਨੰਬਰ ਦਸ ਹੈ ਇਸ ਲਈ ਮੈਨੂੰ ਮੇਰੇ ਨਵੇਂ ਪਤੇ ਬਿੱਲ ਲਈ ਨਵੀਂ ਮੇਲ ਸੈਂਡ ਕੀਤੀ ਜਾਵੇ